ਮੈਂ ਹੁਣ ਪਹਿਲਾਂ ਵਾਂਗ ਟਰੈਕਿੰਗ ਸਿਖ ਸਾਈਟਾਂ 'ਤੇ ਕੋਈ ਵੀ ਮਤਲਬ ਇੰਨਾ ਗੰਦ ਨਹੀਂ ਦੇਖਿਆ ਹੁਣ ਬਹੁਤ ਹੀ ਸਫਾਈ ਹੁੰਦੀ ਹੈ ਕਿਉਂਕਿ ਜੋ ਅੱਜ ਦੀ ਯੁਵਾ ਪੀੜ੍ਹੀ ਹੈ ਜੋ ਪੜ੍ਹੀ ਲਿਖੀ ਹੈ ਨੌਜਵਾਨ ਪੀੜ੍ਹੀ ਉਹ ਸਫਾਈ ਵੱਲ ਬਹੁਤ ਧਿਆਨ ਦੇ ਰਹੀ ਹੈ ਜਿਸ ਕਾਰਨ ਵਾਤਾਵਰਨ ਬਹੁਤ ਹੀ ਸਾਫ ਰਹਿੰਦਾ ਹੈ ਅਤੇ ਮੈਂ ਜਦ ਵੀ ਕਿਤੇ ਟਰੈਕਿੰਗ 'ਤੇ ਜਾਂਦੀ ਹਾਂ ਸਮਾਨ ਕੈਰੀ ਕਰਦੀ ਹਾਂ ਅਤੇ ਕੁਛ ਵੀ ਸਮਾਨ ਜੋ ਹੁੰਦਾ ਏ ਜਾਂ ਤਾਂ ਮੈਂ ਮਤਲਬ ਰਸਤੇ ਦੇ ਵਿੱਚ ਜਾਂ ਕੋਈ ਡਸਟਵਿਨ ਆ ਮੈਂ ਉਹਦੇ ਵਿੱਚ ਸੁੱਟ ਦਿੰਦੀ ਹਾਂ ਜਾਂ ਮੈਂ ਉਸਨੂੰ ਆਪਣੇ ਨਾਲ ਲੈ ਆਉਂਦੀ ਹਾਂ ਅਤੇ ਮੈਨੂੰ ਜਦ ਵੀ ਕਿਤੇ ਟਰੈਕਿੰਗ ਕਰਨ ਦਾ ਸਮਾਂ ਮਿਲਦਾ ਹੈ ਤਾਂ ਮੈਂ ਵੱਧ ਤੋਂ ਵੱਧ ਸਫਾਈ ਕਰਨ ਦੇ ਵੱਲ ਧਿਆਨ ਦਿੰਦੀ ਹਾਂ ਕਿਉਂਕਿ ਅੱਜ ਕੱਲ੍ਹ ਦਾ ਵਾਤਾਵਰਨ ਬਹੁਤ ਹੀ ਸਾਫ ਅਤੇ ਸੋਹਣਾ ਅਤੇ ਸਫਾਈ ਵਾਲਾ ਹੋ ਗਿਆ ਹੈ ਅੱਜ ਕੱਲ੍ਹ ਕੋਈ ਵੀ ਵਾਤਾਵਰਨ ਨੂੰ ਇੰਨਾ ਮਤਲਬ ਕਿ ਗੰਦਾ ਨਹੀਂ ਕਰਦਾ ਹਰ ਕੋਈ ਸਫਾਈ ਵੱਲ ਧਿਆਨ ਦਿੰਦਾ ਹੈ ਅੱਜ ਕੱਲ੍ਹ ਨੌਜਵਾਨ ਪੜ੍ਹੀ ਲਿਖੀ ਪੀੜ੍ਹੀ ਬਹੁਤ ਹੀ ਸਮਝਦਾਰ ਹੋ ਗਈ ਹੈ ਜਿਨ੍ਹਾਂ ਨੂੰ ਸਫਾਈ ਦਾ ਬਹੁਤ ਹੀ ਬਹੁਤ ਹੀ ਕਰਨਾ ਸਫਾਈ ਕਰਨਾ ਬਹੁਤ ਹੀ ਪਸੰਦ ਹੈ ਇਸ ਕਰਕੇ ਮੈਂ ਅੱਜ ਤੱਕ ਟਰੈਕਿੰਗ ਕੀਤੇ ਹੈ ਜਿੰਨੇ ਵੀ ਟਰੈਕਿੰਗ ਕੀਤਾ ਹੈ ਮੈਂ ਉਹਦੇ ਵਿੱਚ ਜ ਵੱਧ ਤੋਂ ਵੱਧ ਸਫਾਈ ਹੀ ਦੇਖੀ ਹੈ ਵਾਤਾਵਰਨ ਸਾਫ ਹੀ ਦੇਖਿਆ ਹੈ ਇਸ ਕਰਕੇ ਮੈਂ ਖੁਦ ਵੀ ਜਦੋਂ ਵੀ ਮੈਨੂੰ ਕੋਈ ਟਰੈਕਿੰਗ ਮਿਲਦਾ ਹੈ ਮੈਨੂੰ ਕੋਈ ਸਮਾਂ ਮਿਲਦਾ ਹੈ ਮੈਂ ਵੱਧ ਤੋਂ ਵੱਧ ਸਫਾਈ ਵੱਲ ਧਿਆਨ ਦਿੰਦੀ ਹਾਂ ਇਸ ਕਰਕੇ ਸਾਡਾ ਵਾਤਾਵਰਣ ਹੁਣ ਬਹੁਤ ਹੀ ਬਦਲ ਗਿਆ ਹੈ ਬਹੁਤ ਹੀ ਸਫਾਈ ਵਾਲਾ ਅਤੇ ਬਹੁਤ ਹੀ ਵਧੀਆ ਹੋ ਗਿਆ ਹੈ